ਜੇਕਰ ਮੈਂ ਗੱਲ ਕਰਾਂ ਕਿ ਕਿਲ੍ਹਿਆ ਜਾਂ ਮਹਿਲਾਂ ਦੀ ਵੈਸੇ ਤਾਂ ਮੇਰੇ ਸ਼ਹਿਰ ਦੇ ਆਲੇ ਦੁਆਲੇ ਕਿਲ੍ਹੇ ਜਾਂ ਮਹਿਲ ਤਾਂ ਨਹੀਂ ਹੈ ਪਰ ਮੇਰੇ ਸ਼ਹਿਰ ਤੋਂ ਚੌਦਾਂ ਕਿਲੋਮੀਟਰ ਦੀ ਦੂਰੀ 'ਤੇ ਭਾਰਤ ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਹੈ ਜਿਸ ਦਾ ਨਾਮ ਕੀ ਸਾਦਕੀ ਇੰਟਰ ਸਾ ਸਾਧਕੀ ਭਾਰਤ ਪਾਕਿਸਤਾਨ ਬੋਡਰ ਹੈ ਅਤੇ ਉਸ ਤੋਂ ਪਹਿਲਾਂ ਪਹਿਲਾਂ ਵੀ ਸੱਤ ਕਿਲੋਮੀਟਰ ਆਸਫ਼ਵਾਲਾ ਵੋਰ ਮੈਮੋਰੀਅਲ ਦੇ ਨਾਮ ਤੋਂ ਇੱਕ ਮਿਊਜ਼ਅਮ ਆਉਂਦਾ ਹੈ ਜਿੱਥੇ ਕਿ ਸਮਾਧੀ ਵੀ ਬਣੀ ਹੋਈ ਹੈ ਅਤੇ ਵੋਰ ਮੈਮੋਰੀਅਲ ਵੀ ਹੈ ਇਹ ਵੋਰ ਮੈਮੋਰੀਅਲ ਨਾਈਨਟੀਨ ਸੈਵਨਟੀ ਵੰਨ ਦੇ ਵੋਰ ਵੋਰ ਦੇ ਜਿਹੜੇ ਸ਼ਹੀ ਸ਼ਹੀਦ ਫੌ ਸ਼ਹੀਦ ਹੋਏ ਸੀ ਫੌਜੀ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਨਾਮ ਉੱਤੇ ਇਹ ਮਿਊਜ਼ੀਅਮ ਬਣਿਆ ਗਿ ਬਣਿਆ ਹੋਇਆ ਹੈ ਅਤੇ ਇਹ ਵੀ ਗੱਲ ਇੱਕ ਜ਼ਿਕਰਯੋਗ ਹੈ ਕਿ ਉ ਨਾਈਨਟੀਨ ਸੈਵਨਟੀ ਵ ਵੰਨ ਦੀ ਵੋਰ ਵਿੱਚ ਜਿਹੜੇ ਕਿ ਫੋ ਆਰਮੀ ਫ ਫੌਜੀ ਸ਼ਹੀਦ ਹੋਏ ਸੀਗੇ ਉਹਨਾਂ ਦੀ ਅੰਤਿਮ ਸੰਸਕਾਰ ਵੀ ਉੱਥੇ ਹੀ ਕੀਤਾ ਗਿਆ ਸੀਗਾ ਤਾਂ ਇਸ ਕਰਕੇ ਉਸ ਵੋਰ ਮੈਮੋਰੀਅਲ ਦਾ ਬਹੁਤ ਹੀ ਬਹੁਤ ਹੀ ਮਹੱਤਤਾ ਹੈ ਬਹੁਤ ਹੀ ਮਹੱਤਤਾ ਹੈ ਉੱਥੇ ਇੱਕ ਹੁਣੇ ਹੀ ਕੁਝ ਸਾਲ ਪਹਿਲਾਂ ਹੀ ਸੈਵਨਟੀ ਵੰਨ ਮੀਟਰ ਉੱਚਾ ਇੱਕ ਵਿਕਟਰੀ ਵੋਲ ਵਿਕਟਰੀ ਵਿਕਟਰੀ ਵੋਲ ਵੀ ਬਣੀ ਹੈ ਜੋ ਕਿ ਬਹੁਤ ਹੀ ਦੇਖਣ ਯੋਗ ਹੈ ਜੇ ਤਾਂ ਹੁਣ ਜੇ ਗੱ ਗੱਲ ਕਰਾਂ ਤਾਂ ਭਾਰਤ ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਦੀ ਤਾਂ ਹੀ ਇਹ ਮੇਰੇ ਸ਼ਹਿਰ ਤੋਂ ਬਿਲਕੁਲ ਚੋਦਾਂ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਇਹ ਇਸ ਬਾਰਡਰ ਨੇ ਨਾਈਨਟੀ ਸੈਵਨਟੀ ਵੰਨ ਅਤੇ ਨਾਈਨਟੀ ਸਿਕਸਟੀ ਫਾਈਵ ਦੀ ਜੰਗ ਵੀ ਵੇਖੀ ਹੈ ਜੰਗ ਵੀ ਵੇਖੀ ਹੈ ਇਸ ਇਸ ਕਰਕੇ ਇਸ ਬੋਡਰ ਦੀ ਵੀ ਬਹੁਤ ਬਹੁਤ ਮਹੱਤਤਾ ਹੈ ਇਹ ਇਸ ਕਰਕੇ ਇਹ ਸ਼ਹਿਰ ਫ਼ਾਜ਼ਿਲਕਾ ਦੇ ਬਹੁਤ ਹੀ ਰਮਨੀਕ ਸਥਾਨ ਹਨ ਜੋ ਕਿ ਦੇਖਣ ਯੋਗ ਹਨ ਦਰ ਬਹੁਤ ਹੀ ਦੂਰੋਂ ਦੂਰੋਂ ਦੂਰੋਂ ਲੋਕ ਇਸ ਜਗ੍ਹਾ ਨੂੰ ਵੇਖਣ ਵਾਸਤੇ ਆਉਂਦੇ ਹਨ ਧੰਨਵਾਦ